ਹਰਜਸ ਤੁਸੀਂ ਆਪਣੀ ਹੋਬੀ ਦੇ ਵਿੱਚ ਪੇਂਟਿੰਗ ਲਿਖਿਆ ਅਤੇ ਪੇਂਟਿੰਗ ਦੇ ਤੁਸੀਂ ਕਦੇ ਐਗਜ਼ੀਬਿਸ਼ਨ ਲਈ ਹੈ ਹਾਂਜੀ ਮੈਂ ਐਗਜ਼ੀਬਿਸ਼ਨ ਪੇਂਟਿੰਗ ਦੀ ਲਗਾਈ ਹੈ ਅਤੇ ਮੈਂ ਕੋਲਜ ਦੇ ਅੰਦਰ ਹੀ ਐਗਜ਼ੀਬੇਸ਼ਨਜ਼ ਲਗਾਈਆਂ ਨੇ ਗਿਆਨ ਸਾਗਰ ਮੈਡੀਕਲ ਕੋਲਜ ਰਾਜਪੁਰਾ ਦੇ ਅੰਦਰ ਮੈਂ ਪਹਿਲੀ ਵਾਰੀ ਆਪਣੀ ਐਗਜ਼ੀਬਿਸ਼ਨ ਲਗਾਈ ਸੀ ਅਤੇ ਲੋਕਾਂ ਨੇ ਉਥੇ ਸਾਰੀਆਂ ਪੇਂਟਿੰਗਜ਼ ਬਹੁਤ ਪਸੰਦ ਕੀਤੀਆਂ ਸੀ